ਆਪਣੇ ਸੁਰਾਂ ਦੀ ਗਹਿਰਾਈ ਨੂੰ ਵਧਾਉਣ ਵਾਸਤੇ ਗਲੇ ਦੀ ਥਾਂ 'ਤੇ ਪੇਟ ਦੀ ਸਹਾਇਤਾ ਨਾਲ ਆਵਾਜ਼ ਨੂੰ ਕੱਢਣਾ ਚਾਹੀਦਾ ਹੈ ਅਤੇ ਸਾਹ ਨੂੰ ਲੰਬਾ ਰੱਖਣਾ ਚਾਹੀਦਾ ਹੈ ਅਤੇ ਰਿਆਜ਼ ਨੂੰ ਜਿਹੜਾ ਕਿ ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮ ਨੂੰ ਸਾਹ ਦੀ ਸਾਧਨਾ ਕਰਨੀ ਚਾਹੀਦੀ ਹੈ